ਅੱਜ ਕੱਲ੍ਹ ਟੈਕਨੋਲਜੀ ਨੇ ਬਹੁਤ ਟੈਕਨੋਲਜੀ ਦੇ ਕਾਰਨ ਬਹੁਤ ਤਰੱਕੀ ਕਰ ਹੋ ਗਈ ਹੈ ਲੋਕਾਂ ਪਹਿਲਾਂ ਲੋਕ ਇੱਕ ਦੂਜੇ ਨਾਲ ਗੱਲ ਕਰਨ ਲਈ ਚਿੱਠੀਆਂ ਦੀ ਵਰਤੋਂ ਕਰਦੇ ਸਨ ਪਰ ਅੱਜ ਕੱਲ੍ਹ ਕੀ ਹੈ ਕਿ ਟੈਕਨੋਲਜੀ ਦੇ ਵਧਣ ਨਾਲ ਅੱਜ ਕੱਲ੍ਹ ਲੋਕ ਮੋਬਾਈਲ ਫੋਨ ਦੀ ਵਰਤੋਂ ਬਹੁਤ ਵੱਧ ਗਈ ਹੈ ਅਤੇ ਅੱਜ ਕੱਲ੍ਹ ਮੋਬਾਈਲ ਫੋਨ ਦੀ ਵਰਤੋਂ ਨਾਲ ਲੋਕ ਇੱਕ ਦੂਜੇ ਨਾਲ ਦੂਰ ਵਿਦੇਸ਼ਾਂ ਵਿੱਚ ਬੈਠੇ ਵੀ ਵੀਡੀਓ ਕਾਲ 'ਤੇ ਗੱਲ ਕਰ ਸਕਦੇ ਹਨ ਅਤੇ ਇਸੇ ਤਰ੍ਹਾਂ ਅੱਜ ਕੱਲ੍ਹ ਲ ਲੋਕਾਂ ਨੂੰ ਓਨਾ ਟੈਕਨੋਲਜੀ ਵਧਣ ਦੇ ਕਾਰਨ ਲੋਕਾਂ ਨੂੰ ਓਨਾ ਮਹਿਸੂਸ ਨਹੀਂ ਹੁੰਦਾ ਕਿ ਦੂਰ ਬੈਠੇ ਵੀ ਰਿਸ਼ਤੇਦਾਰਾਂ ਨਾਲ ਉਹ ਗੱਲਬਾਤ ਕਰ ਕਰ ਸਕਦੇ ਹਨ ਅਤੇ ਇਸੇ ਤਰ੍ਹਾਂ ਹੀ ਤੈਕਨੋਲੋਜੀ ਦੇ ਵਧਣ ਨਾਲ ਅੱਜ ਕੱਲ੍ਹ ਬੈਂਕਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਲੋਕ ਇੱਥੇ ਹੀ ਅ ਆਨਲਾਈਨ ਹੀ ਪੇਮੈਂਟ ਕਢਵਾ ਲੈਂਦੇ ਹਨ ਤਾਂ ਇਸੇ ਤਰ੍ਹਾਂ ਤੈੈੈਕਨੌਲਜੀ ਵਧਣ ਦੇ ਕਾਰਨ ਲੋਕਾਂ ਨੂੰ ਬਹੁਤ ਸੁੱਖ ਸੁਵਿਧਾਵਾਂ ਮਿਲੀਆਂ ਹਨ ਅਤੇ ਲੋਕ ਇੱਕ ਦੂਜੇ ਇੱਕ ਦੂਜੇ ਨਾਲ ਜ਼ਿਆਦਾ ਜੁੜ ਜੁੜ ਗਏ ਹਨ ਅਤੇ ਤੈਕਨੋਲਜੀ ਦੇ ਕੰਪਿਊਟਰ ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਚੱਲ ਰਿਹਾ ਹੈ ਅਤੇ ਕੰਪਿਊਟਰ ਕੰਪਿਊਟਰ ਦੀ ਵਰਤੋਂ ਨਾਲ ਅੱਜ ਕੱਲ੍ਹ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹੈ ਅਤੇ ਇਸ ਬੱਚੇ ਵੀ ਇਸ ਦੀ ਵਰਤੋਂ ਕ ਕਰ ਰਹੇ ਹਨ ਅਤੇ ਇਸੇ ਨਾਲ ਹੀ ਲੋ ਅੱਜ ਕੱਲ੍ਹ ਲੋਕਾਂ ਨੂੰ ਬਿੱਲ ਭਰਨ ਵਾਸਤੇ ਵੀ ਬਿਜਲੀ ਬੋਰਡ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਲੋਕ ਬਿੱਲ ਜੀ ਪੇ ਰਾਹੀਂ ਹੀ ਕਰ ਦਿੰਦੇ ਹਨ ਤਾਂ ਇਸੇ ਤਰ੍ਹਾਂ ਟੈਕਨੋਲਜੀ ਦਾ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹੈ ਅਤੇ ਲੋਕ ਬਹੁਤ ਅੱਗੇ ਵੱਧ ਰਹੇ ਹਨ